ਇੱਕ ਜਨਵਰੀ ਦੋ ਹਜ਼ਾਰ ਉੱਨੀ ਨਵੰਬਰ ਦੋ ਹਜ਼ਾਰ ਦਸ ਛੇ ਅਗਸਤ ਉੱਨੀ ਸੌ ਸੰਤਾਲ਼ੀ ਪੰਦਰ੍ਹਾਂ ਅਕਤੂਬਰ ਦੋ ਹਜ਼ਾਰ ਵੀਹ ਅਠਾਰ੍ਹਾਂ ਅਪ੍ਰੈਲ ਉੱਨੀ ਸੌ ਪੰਜਾਹ